ਮੈਂ ਇਕ ਯਾਦਗਾਰ ਡਰਾਇੰਗ ਦਾ ਅਨੁਭਵ ਤੁਹਾਡੇ ਨਾਲ ਸਾਂਝਾ ਕਰਦਾ ਹਾਂ ਇੱਕ ਵਾਰੀ ਸਾਡੇ ਕਾਲਜ ਦੇ ਵਿੱਚ ਡਰਾਇੰਗ ਕੰਪਟੀਸ਼ਨ ਸੀ ਤੇ ਉਸ ਦੇ ਵਿੱਚ ਮੈਂ ਵੀ ਭਾਗ ਲਿੱਤਾ ਸੀ ਉਸ ਦੇ ਵਿੱਚ ਜਦੋਂ ਸਾਡੇ ਸਹਾਮਣੇ ਡਰਾਇੰਗ ਬਣਵਾਲੀ ਬਣਾ ਲਈ ਤੇ ਐਂਡ ਦੇ ਵਿੱਚ ਜਦੋਂ ਮੇਰੀ ਵਾਰੀ ਆਈ ਤਾਂ ਉਥੇ ਦੇ ਜਿਹੜੇ ਮਹਾਨ ਡਰਾਇੰਗ ਦੇ ਵਿੱਚ ਸਰ ਸੀਗੇ ਇਹਨਾਂ ਨੇ ਮੈਨੂੰ ਵੱਖਰੀ ਸ਼ਾਬਾਸ਼ ਦਿੱਤੀ ਇਨੇ ਸਾਰੇ ਬੱਚਿਆਂ ਦੇ ਵਿੱਚੋਂ ਉਹ ਅਨੁਭਵ ਮੈਂ ਕਦੀ ਨਹੀਂ ਭੁੱਲ ਸਕਦਾ ਮੇਰੇ ਹਿਸਾਬ ਦੇ ਨਾਲ ਜੇ ਕੋਈ ਵੀ ਬੱਚਾ ਹੈ ਤੇ ਉਸਨੂੰ ਉਸਦੀ ਡਰਾਇੰਗ ਦੇ ਵਿੱਚ ਫੀਡਬੈਕ ਤੇ ਕੋਈ ਵੀ ਮਹਾਨ ਹਸਤੀ ਦਿੰਦਾ ਹੈ ਤਾਂ ਉਹ ਉਸਦੇ ਕੋਨਫੀਡੈਂਸ ਨੂੰ ਬਹੁਤ ਬੁਰੀ ਤਰਾਂ ਵਧਾ ਦਿੰਦਾ ਹੈ ਤੇ ਉਹ ਬੰਦਾ ਅੱਗੇ ਜਾ ਕੇ ਤਰੱਕੀ ਬਹੁਤ ਜਿਆਦਾ ਕਰਦਾ ਹੈ ਮੇਰੇ ਹਿਸਾਬ ਦੇ ਨਾਲ ਦੂਜਿਆਂ ਤੋਂ ਫੀਡਬੈਕ ਅਤੇ ਅਲੋਚਨਾ ਇਸ ਦੇ ਵਿੱਚ ਇਸ ਤਰਾਂ ਸ਼ਾਮਿਲ ਹੁੰਦੀ ਹੈ ਕਿ ਬੱਚਾ ਜਦੋਂ ਜਿੱਦਾਂ ਜਿੱਦਾਂ ਆਲੋਚਨਾ ਤੇ ਫੀਡਬੈਕ ਦੂਸਰਿਆਂ ਕੋਲੋਂ ਲੈਂਦਾ ਹੈ ਉਹ ਸਿੱਖਦਾ ਹੈ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵੱਧਦਾ ਹੈ